ਅਸੀਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਸ ਦੇ ਵਿੱਚ ਆਪਣੇ ਰਿਸ਼ਤੇਦਾਰਾਂ 'ਚ ਵਾਤਾਵਰਨ ਵਿੱਚ ਪੰਜਾਬੀ ਬੋਲੀ ਵੱਧ ਤੋਂ ਵੱਧ ਬੋਲਣੀ ਚਾਹੀਦੀ ਔਰ ਬੋਲਣ ਨੂੰ ਸਖਤ ਕਰਨਾ ਚਾਹੀਦਾ ਹੈ ਲੋਕਾਂ ਨੂੰ ਕਿ ਪੰਜਾਬੀ ਬੋਲਣ ਅਤੇ ਜੋ ਕਿ ਦੂਸਰੇ ਨੰਬਰ 'ਤੇ ਅਸੀਂ ਇਸ ਪੰਜਾਬੀ ਨੂੰ ਵੱਧ ਤੋਂ ਵੱਧ ਲਿਖਣਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਪੰਜਾਬੀ ਬਾਰੇ ਪ੍ਰੇਰਿਤ ਕਰਨਾ ਚਾਹੀਦਾ ਔਰ ਸਕੂਲਾਂ ਦੇ ਵਿੱਚ ਜੋ ਇਸਦਾ ਪ੍ਰਚਾਰ ਘੱਟ ਰਿਹਾ ਉਹਨੂੰ ਪ੍ਰਚਾਰ ਕਰਨਾ ਚਾਹੀਦਾ ਕਿ ਪੰਜਾਬੀ ਨੂੰ ਵੱਧ ਤੋਂ ਵੱਧ ਬੋਲਿਆ ਜਾਵੇ ਸੁਣਿਆ ਜਾਵੇ ਅਤੇ ਲਿਖਿਆ ਜਾਵੇ ਠੀਕ ਆ ਜੀ ਇਹ ਪੰਜਾਬੀ ਇੱਕ ਸਾਡੀ ਖੇਤਰੀ ਭਾਸ਼ਾ ਅਜਿਹੀ ਹੈ ਜੋ ਕਿ ਸਾਰੀ ਦੁਨੀਆਂ ਦੇ ਵਿੱਚ ਇਹਦਾ ਵੱਖਰਾ ਹੀ ਪਹਿਚਾਣ ਹੈ ਇਹ ਆਪਣੇ ਬੱਚਿਆਂ ਨੂੰ ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ 'ਚ ਪੜ੍ਹਨ ਪਾ ਰਹੇ ਹਨ ਜੋ ਕਿ ਪੰਜਾਬੀ ਤੋਂ ਵਾਂਝੇ ਰਹਿ ਰਹੇ ਹਨ ਉਹਨਾਂ ਪਰਿਵਾਰਾਂ ਨੂੰ ਵੀ ਚਾਹੀਦਾ ਵੀ ਘਰ ਵਿੱਚ ਪੰਜਾਬੀ ਬੋਲਣੀ ਸਿਖਾਈ ਜਾਵੇ ਲਿਖਣੀ ਸਿਖਾਈ ਜਾਵੇ ਅਤੇ ਪੰਜਾਬੀ ਕਲਚਰ ਬਾਰੇ ਕੁਝ ਨਾ ਕੁਝ ਦੱਸਿਆ ਜਾਵੇ ਇਸ ਤਰ੍ਹਾਂ ਕਰਨ ਨਾਲ ਪੰਜਾਬੀ ਬੋਲੀ ਦਾ ਪ੍ਰਚਾਰ ਵੀ ਹੋਵੇਗਾ ਅਤੇ ਲੋਕ ਇਹਦੀ ਬੱਚਿਆਂ ਦੀ ਇਹਦੇ ਵਿੱਚ ਦਿਲਚਸਪੀ ਵਧੇਗੀ ਠੀਕ ਹੈ ਜੀ ਅਤੇ ਪੰਜਾਬੀ ਜੋ ਵੀ ਸਾਡੇ ਪੰਜਾਬ ਵਿੱਚ ਸਾਡੀ ਮਾਂ ਬੋਲੀ ਮੇਨ ਭਾਸ਼ਾ ਹੈ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਹੋਣਾ ਚਾਹੀਦਾ ਇਹਦੇ ਵੱਧ ਤੋਂ ਵੱਧ ਕੈਂਪ ਲੱਗਣੇ ਚਾਹੀਦੇ ਹਨ ਅਗਰ ਕਾਲਜ ਫੰਕਸ਼ਨ ਕੋਈ ਹੁੰਦਾ ਅਤੇ ਇਸ ਦੇ ਵਿਸ਼ੇ 'ਤੇ ਕੁਛ ਨਾ ਕੁਛ ਜ਼ਰੂਰ ਬੋਲਿਆ ਜਾਏਗਾ